ਜਿਵੇਂ ਕਿ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਹਾਂ ਵੀ ਟੈਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਬੜੇ ਤਰੀਕ ਬਹੁਤ ਵਧੀਆ ਤਰੀਕੇ ਨਾਲ ਬਦਲਿਆ ਹੇ ਜਿਵੇਂ ਕਿ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਵੀ ਜਿਵੇਂ ਸਾਡੇ ਕੋਲ ਹੁਣ ਫੋਨ ਆ ਗਿਆ ਹੈ ਅਤੇ ਜਿੱਦਾਂ ਅਸੀਂ ਕੰਟੈਕਟ ਆ ਕਿਸੇ ਨੂੰ ਕਿਸੇ ਨੂੰ ਵੀ ਜਿੱਦਾਂ ਅਸੀਂ ਫੋਨ ਕਰ ਸਕਦੇ ਹਾਂ ਇੱਥੇ ਬੈਠੇ ਆਪਾਂ ਕਿਸੇ ਵੀ ਆਪਣੇ ਦੂਰ ਰਿਸ਼ਤੇਦਾਰ ਭੈਣ ਭਰਾ ਕਿਤੇ ਵੀ ਗਿਆ ਹੋਵੇ ਤਾਂ ਉਹ ਨਾਲ ਆਪਾਂ ਗੱਲ ਕਰ ਸਕਦੇ ਹਾਂ ਵੀ ਦਿਲ ਦੀ ਗੱਲ ਕਿਤੇ ਵੀ ਸਾਂਝੀ ਕਰ ਸਕਦੇ ਹਾਂ ਅਤੇ ਉਹ ਤੋਂ ਇਲਾਵਾ ਜਿਵੇਂ ਨਾਲ ਫੋਨ ਦੇ ਵਿੱਚ ਹੋਰ ਆਪਸ਼ਨਾਂ ਆ ਗਈਆਂ ਵੀ ਜਿਵੇਂ ਵੀਡੀਓ ਕੋਲ ਹੁੰਦੀ ਆ ਅਸੀਂ ਫੇਸ ਟੂ ਫੇਸ ਉੱਦਾਂ ਕਿੱਦਾਂ ਕੋਈ ਇੱਕ ਦੂਜੇ ਦੇ ਆਵੇ ਘਰ ਅਤੇ ਫਿਰ ਇੱਦਾਂ ਔਖਾ ਹੋ ਜਾਂਦਾ ਤਾਂ ਇੱਦਾਂ ਫੋਨ ਰਾਹੀਂ ਅਸੀਂ ਟੈਕਨੋਲਜੀ ਦੀ ਮਦਦ ਨਾਲ ਵੀਡੀਓ ਕੋਲ ਨਾਲ ਇੱਕ ਦੂਜੇ ਦੇ ਸਾਹਮਣੇ ਅਸੀਂ ਉਹਨਾਂ ਦਾ ਫੇਸ ਟੂ ਫੇਸ ਗੱਲ ਵੀ ਕਰ ਸਕਦੇ ਹਾਂ ਅਤੇ ਉਹਨਾਂ ਦਾ ਹਾਲ ਚਾਲ ਵੀ ਪੁੱਛ ਸਕਦੇ ਹਾਂ ਅਤੇ ਦੂਜਾ ਹੈਗਾ ਵੀ ਪੇਮੈਂਟ ਜਿੱਦਾਂ ਅਸੀਂ ਪੈਸੇ ਦੇਣ ਨੂੰ ਪੈਸੇ ਦੇਣੇ ਹੋਣ ਜਿੱਦਾਂ ਹੁਣ ਬੈਂਕ ਦੇ ਵਿੱਚ ਕਢਾਉਣੇ ਜਾਣੇ ਹੋਣ ਤਾਂ ਲਾਇਨਾਂ ਵਿੱਚ ਖਲੋ ਕੇ ਸਾਨੂੰ ਪੈਸੇ ਕਢਾਉਣੇ ਪੈਂਦੇ ਆ ਅਤੇ ਹੁਣ ਟੈਕਨੋਲਜੀ ਨੇ ਇੰਨਾ ਕੁ ਕੀਤਾ ਵੀ ਜਿਵੇਂ ਗੂਗਲ ਪੇ ਫੋਨਪੇ ਇੱਦਾਂ ਦੀਆਂ ਓਪਸ਼ਨਾਂ ਆ ਚੁੱਕੀਆਂ ਤਾਂ ਅਸੀਂ ਇੱਕ ਦੂਜੇ ਰਾਹੀਂ ਇੱਦਾਂ ਹੀ ਪੇਮੈਂਟ ਕਰ ਦਿੰਦੇ ਹਾਂ ਠੀਕ ਆ ਅਤੇ ਉਸ ਤੋਂ ਬਾਅਦ ਆ ਗਿਆ ਵੀ ਜਿਵੇਂ ਅਸੀਂ ਟਿਕਟ ਔਨਲਾਈਨ ਬੁੱਕ ਕਰਾਉਣੀ ਹੋਵੇ ਟੈਕਨੋਲਜੀ ਦੀ ਮਦਦ ਨਾਲ ਅਸੀਂ ਔਨਲਾਈਨ ਟਿਕਟ ਵੀ ਬੁੱਕ ਕਰਾ ਸਕਦੇ ਹਾਂ ਕੋਈ ਚੀਜ਼ ਜਿੱਦਾਂ ਆਪਾਂ ਕਿਸੇ ਖਰੀਦਣੀ ਹੋਵੇ ਉਹ ਵੀ ਬਾਏ ਕਰ ਸਕਦੇ ਹਾਂ ਸੇਲ ਵੀ ਕਰ ਸਕਦੇ ਹਾਂ ਡਾਟਾ ਵੀ ਸਟੋਰ ਕਰ ਸਕਦੇ ਹਾਂ ਆਪਾਂ ਹਾਂਜੀ